ਅੱਜ ਸਾਡੇ ਦੇਸ਼ ਵਿੱਚ ਭਿੰਨ ਭਿੰਨ ਧਰਮਾਂ ਦੇ ਲੋਕ ਰਹਿੰਦੇ ਹਨ ਜਿਸ ਕਾਰਨ ਸਾਡੇ ਦੇਸ਼ ਵਿੱਚ ਧਾਰਮਿਕ ਏਕਤਾ ਬਹੁਤ ਮੌਜੂਦ ਹੈ ਸਾਡੇ ਦੇਸ਼ ਵਿੱਚ ਭਿੰਨ ਭਿੰਨ ਲੋਕ ਲੋਕਾਂ ਲਈ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਉਹ ਜਿੱਥੇ ਉਹ ਜਾ ਕੇ ਨਿੱਤ ਆਪਣਾ ਸਿਮਰਨ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਜੇਕਰ ਅਸੀਂ ਕਾਰੋਬਾਰ ਦੀ ਗੱਲ ਕਰੀਏ ਤਾਂ ਧਰਮ ਦੇ ਨਾਲ ਕਾਰੋਬਾਰ ਦਾ ਇਸ ਤਰੀਕੇ ਨਾਲ ਸੰਬੰਧ ਹੈ ਕਿ ਇੱਥੇ ਹਰ ਇੱਕ ਧਰਮ ਵਿੱਚ ਜੋ ਹੈ ਗੀਤਕਾਰ ਮੌਜੂਦ ਹੁੰਦੇ ਹਨ ਜੋ ਕਿ ਆਪਣੀ ਆਪਣੇ ਭਾਵਾਂ ਆਪਣੇ ਵਿਚਾਰਾਂ ਨੂੰ ਲੋਕਾਂ ਅੱਗੇ ਗੀਤਾਂ ਦੁਆਰਾ ਪੇਸ਼ ਕਰਦੇ ਹਨ ਜਿਸ ਨਾਲ ਲੋਕਾਂ ਦੇ ਧਾਰਮਿਕ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਬਹੁਤ ਸਾਰੇ ਬਹੁਤ ਸਾਰੇ ਜੋ ਕਿ ਧਾਰਮਿਕ ਜਗਰਾਤੇ ਆਦਿ ਹੁੰਦੇ ਹਨ ਜਿਹਨਾਂ ਵਿੱਚ ਲੋਕ ਵਿਅਕਤੀ ਬਹੁਤ ਹੀ ਵੱਧ ਚੜ ਕੇ ਹਿੱਸਾ ਲੈਂਦੇ ਹਨ ਇਸ ਵਿੱਚ ਗੀਤਕਾਰ ਗੀਤਕਾਰਾਂ ਦੀ ਬਹੁਤ ਹੀ ਆਰਥਿਕ ਸਥਿਤੀ ਬਹੁਤ ਹੀ ਮਜ਼ਬੂਤ ਹੁੰਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਪ੍ਰੋਗਰਾਮ ਜੋ ਕਿ ਧਾਰਮਿਕ ਧਾਰਮਿਕ ਪ੍ਰੋਗਰਾਮ ਜੋ ਕਿ ਟੀ ਵੀ 'ਤੇ ਟੈਲੀਕਾਸਟ ਹੁੰਦੇ ਹਨ ਜਿਸ ਨਾਲ ਵਿਅਕਤੀਆਂ ਦੇ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਨਾਲ ਦੇਸ਼ ਦੀ ਵੀ ਉੱਨਤੀ ਹੁੰਦੀ ਹੈ